ਯੋਗਾ ਸਾਡੇ ਜੀਵਨ ਦਾ ਇੱਕ ਅੰਗ ਹੈਗਾ ਹੈ ਇਹ ਨਹੀਂ ਕਹਿ ਸਕਦੇ ਕਿ ਯੋਗਾ ਕਿਸੇ ਵਿਸ਼ੇਸ਼ ਪਰਿਸਥਿਤੀ ਵਿੱਚ ਹੀ ਕੀਤਾ ਜਾਣਾ ਚਾਹੀਦਾ ਹੈ ਜਾਂ ਯੋਗਾ ਕਰਨ ਦੀ ਜ਼ਰੂਰਤ ਉਦੋਂ ਹੀ ਪੈਂਦੀ ਹੈ ਜਦੋਂ ਕਿ ਬੰਦਾ ਬਿਮਾਰ ਹੋਵੇ ਯੋਗਾ ਹਮਾਰੇ ਜੀਵਨ ਦਾ ਇੱਕ ਐਸ ਇਹੋ ਜਿਹਾ ਅੰਗ ਹੈ ਕਿ ਇਸ ਦੇ ਨਾਲ ਆਪਾਂ ਆਪਦੀ ਬਿਮਾਰੀ ਤੋਂ ਦੂਰ ਰਹਿ ਸਕਦੇ ਹਾਂ ਜਦੋਂ ਵੀ ਆਪਾਂ ਯੋਗਾ ਕਰਨਾ ਸ਼ੁਰੂ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਤਾਂ ਯੋਗਾ ਕਰਨ ਵਾਲੇ ਵਿਅਕਤੀ ਨੂੰ ਸੁਖ ਆਸਣ ਵਿੱਚ ਬਿਠਾਇਆ ਜਾਂਦਾ ਹੈ ਸੁਖ ਆਸਣ ਵਿੱਚ ਬਿਠਾ ਕੇ ਉਸ ਨੂੰ ਧੀਰੇ ਧੀਰੇ ਆਪਦੇ ਸਾਹ ਦੇ ਉੱਤੇ ਆਪਦੇ ਸਾਹਾਂ 'ਤੇ ਧਿਆਨ ਦੇਣ ਦੀ ਜ਼ਰੂਰਤ ਨੂੰ ਸਮਝਾਇਆ ਜਾਂਦਾ ਹੈ ਉਹ ਉਸ ਤੋਂ ਬਾਅਦ ਆਪਾਂ ਅਨਲੋਮ ਵਿਲੋਮ ਦੀ ਪ੍ਰਕਿਰਿਆ ਕਰਾਉਂਦੇ ਹਾਂ ਅਨਲੋਮ ਵਾਲੇ ਰੂਪ ਦੀ ਪ੍ਰਕਿਰਿਆ ਨੂੰ ਪੂਰਾ ਕਰਨ ਤੋਂ ਉਪਰੰਤ ਆਪਾਂ ਵਿਅਕਤੀ ਨੂੰ ਇਹ ਨਿਰਦੇਸ਼ ਦਿੰਦੇ ਹਾਂ ਕਿ ਉਹ ਆਪਦੇ ਪੈਰਾਂ ਨੂੰ ਸਿੱਧਾ ਕਰ ਲਵੇ ਉਸ ਤੋਂ ਬਾਅਦ ਉਹਨਾਂ ਦੇ ਹੱਥਾਂ ਪੈਰਾਂ ਦੀ ਇੱਕ ਵਰਜਿਸ਼ ਕਰਵਾਈ ਜਾਂਦੀ ਹੈ ਉਹ ਹਲਕੇ ਤੌਰ ਦੀ ਵਰਜਿਸ਼ ਹੁੰਦੀ ਹੈ ਉਸ ਤੋਂ ਉਪਰੰਤ ਜਿਹੋ ਜਿਹੇ ਵੀ ਆਸਣ ਦੀ ਜ਼ਰੂਰਤ ਹੁੰਦੀ ਹੈ ਉਹ ਆਸਣ ਲਈ ਆਪਾਂ ਉਸ ਵਿਅਕਤੀ ਨੂੰ ਗਾਈਡ ਕਰਦੇ ਹਾਂ ਯੋਗਾ ਲਈ ਸਭ ਤੋਂ ਮਹੱਤਵਪੂਰਨ ਹੁੰਦਾ ਹੈ ਕਿ ਵਿਅਕਤੀ ਆਪਦੇ ਮਨ ਨਾਲ ਇੱਛਾ ਨਾਲ ਬਿਲਕੁਲ ਸ਼ਾਂਤ ਹੋ ਕੇ ਉਹ ਆਪਦੇ ਆਸਣਾਂ ਵੱਲ ਧਿਆਨ ਕਰੇ ਜਦੋਂ ਕਿ ਸਭ ਤੋਂ ਪਹਿਲਾਂ ਆਪਾਂ ਆਸਣ ਕਰਦੇ ਹਾਂ ਉਹਨਾਂ ਆਸਣਾਂ ਦੇ ਵਿੱਚ ਆਪਾਂ ਵਿਅਕਤੀ ਨੂੰ ਇਹ ਕਹਿੰਦੇ ਹਾਂ ਕਿ ਉਹਨੇ ਕਦੋਂ ਸਾਹ ਲੈਣਾ ਹੈ ਕਦੋਂ ਸਾਹ ਨੂੰ ਰੋਕਣਾ ਹੈ ਅਤੇ ਕਦੋਂ ਸਾਹ ਛੱਡਣਾ ਹੈ ਜਿਵੇਂ ਕਿ ਜਦੋਂ ਕੋਈ ਵੀ ਸਰੀਰ ਦਾ ਪਾਰਟ ਆਪਣੇ ਖਿਚਾਓ ਹੁੰਦਾ ਹੈ ਉਦੋਂ ਸਾਹ ਲੈਣਾ ਹੁੰਦਾ ਹੈ ਉਸ ਤੋਂ ਬਾਅਦ ਕੁਛ ਸਕਿੰਟਾਂ ਲਈ ਸਾਹ ਰੋਕਣਾ ਹੁੰਦਾ ਅਤੇ ਉਸ ਤੋਂ ਬਾਅਦ ਸਾਹ ਛੱਡਣਾ ਹੁੰਦਾ ਹੈ